ਗੁਰਦਾਸ ਮਾਨ ਜੋ ਕਿ ਪੰਜਾਬੀ ਲੋਕ ਗਾਇਕ ਹੈ ਨੂੰ ਮੈਂ ਲਾਈਵ ਸੁਣਿਆ ਹੈ ਅਤੇ ਉਹ ਬੜਾ ਸੋਹਣਾ ਗਾਉਂਦਾ ਹੈ ਅਤੇ ਪੰਜਾਬ ਦੇ ਕਲਚਰ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਮੈਂ ਗੁਰਦਾਸ ਮਾਨ ਨਾਈਟ ਵਿੱਚ ਉਸ ਨੂੰ ਲਾਈਵ ਸੁਣਿਆ ਅਤੇ ਦੇਖਿਆ ਹੈ ਅਤੇ ਉਹ ਬੜਾ ਸੋਹਣਾ ਗਾਉਂਦਾ ਹੈ ਅਤੇ ਲੋਕ ਵੀ ਉਹਨੂੰ ਬਹੁਤ ਚਾਹੁੰਦੇ ਹਨ ਅਤੇ ਸੁਣਨ ਲਈ ਆਏ ਸਨ ਉਸ ਨੂੰ ਵੇਖ ਕੇ ਮੈਂ ਬਹੁਤ ਪ੍ਰਭਾਵ ਪ੍ਰਭਾਵਿਤ ਹੋਇਆ ਅਤੇ ਉੱਥੇ ਭੀੜ ਭੜੱਕਾ ਬਹੁਤ ਸੀ ਅਤੇ ਜਿ ਜਿਸ ਕਰਕੇ ਆਪਣਾ ਉਸਨੂੰ ਆਪਣਾ ਸੁਣਨ ਵਾਸਤੇ ਲੋਕ ਕਾਫੀ ਆਏ ਹੋਏ ਸਨ ਅਤੇ ਮੈਂ ਬਹੁਤ ਬਹੁਤ ਆਨੰਦ ਲਿਆ ਅਤੇ ਆਪਣੇ ਆਪਣਾ ਖੁਸ਼ੀ ਮਹਿਸੂਸ ਕੀਤੀ ਕਿ ਉਹ ਪੰਜਾਬ ਦੇ ਪੰਜਾਬ ਦੇ ਕਲਚਰ ਨੂੰ ਬਹੁਤ ਪ੍ਰਮੋਟ ਕਰ ਰਿਹਾ ਹੈ ਧੰਨਵਾਦ